ਜਿਵੇਂ ਆਪਾਂ ਜਾਣਦੇ ਹਾਂ ਅੱਜ ਕੱਲ੍ਹ ਇੰਟਰਨੈਟ ਉੱਤੇ ਜਿਹੜੀ ਖਰੀਦਦਾਰੀ ਕਰਨੀ ਆ ਬਹੁਤ ਸੌਖੀ ਹੋ ਚੁੱਕੀ ਆ ਉਹਨੇ ਸਾਡਾ ਸਮਾਂ ਵੀ ਬਚਾਇਆ ਸਾਡੇ ਪੈਸੇ ਵੀ ਬਹੁਤ ਬਚਾਏ ਨੇ ਇਸੇ ਤਰ੍ਹਾਂ ਹੀ ਮੈਂ ਇੱਕ ਚਾਰਜਰ ਮੰਗਵਾਇਆ ਦੇਖੋ ਇੱਕ ਗੱਲ ਪਹਿਲਾਂ ਇਹ ਕਹਿਣੀ ਚਾਹੂੰਗਾ ਵੀ ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਨੇ ਹਾਂ ਵਾਚਕ ਵੀ ਹੁੰਦੇ ਨੇ ਅਤੇ ਨਾਂਹ ਵਾਚਕ ਵੀ ਹੁੰਦੇ ਨੇ ਠੀਕ ਹੈ ਜਿਵੇਂ ਖਰੀਦਦਾਰੀ ਆ ਉਹਨੇ ਆਪਣਾ ਸਮਾਂ ਵੀ ਬਚਾਇਆ ਪੈਸੇ ਵੀ ਬਚਾਏ ਨੇ ਅਤੇ ਵਧੀਆ ਚੀਜ਼ਾਂ ਵੀ ਦੇ ਰਹੇ ਨੇ ਉਸੇ ਤਰ੍ਹਾਂ ਨਾਲ ਜਿਹਦੇ ਨਾਂਹ ਪੱਖੀ ਵਰਤਾਰਾ ਇਹ ਵੀ ਆ ਵੀ ਕਈ ਕੰਪਨੀਆਂ ਅਜਿਹੀਆਂ ਨੇਗੀਆਂ ਜੋ ਸਾਨੂੰ ਵਸਤਾਂ ਨੇ ਜੋ ਅਸੀਂ ਮੰਗਵਾ ਰਹੇ ਹਾਂ ਉਹ ਖ਼ਰਾਬ ਭੇਜ ਦਿੰਦੀਆਂ ਨੇ ਜਾਂ ਸਹੀ ਨਹੀਂ ਭੇਜਦੀਆਂ ਜੋ ਜਿੱਦਾਂ ਅਸੀਂ ਮੰਗਵਾਉਂਦੇ ਹਾਂ ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜਿਵੇਂ ਮੈਂ ਆਪਣੇ ਮੋਬਾਇਲ ਫੋਨ ਦਾ ਚਾਰਜਰ ਮੰਗਵਾਇਆ ਖ਼ਰਾਬ ਹੋ ਚੁੱਕਿਆ ਸੀ ਆਮ ਦੁਕਾਨਾਂ ਤੋਂ ਨਹੀਂ ਮਿਲਿਆ ਚਲੋ ਮੈਂ ਕਿਹਾ ਵੀ ਚਲੋ ਆਪਾਂ ਔਨਲਾਈਨ ਮੰਗਵਾ ਲੈਂਦੇ ਹਾਂ ਔਨਲਾਈਨ ਮੰਗਵਾਇਆ ਅਤੇ ਪਹਿਲਾਂ ਤਾਂ ਉਹ ਲੇਟ ਪਹੁੰਚਿਆ ਜੋ ਵੀ ਉਹਨਾਂ ਨੇ ਡੇਟ ਦਿੱਤੀ ਹੋਈ ਸੀ ਵੀ ਇਸ ਤਰੀਕ ਤੱਕ ਚਾਰਜਰ ਤੁਹਾਡਾ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਪਹੁੰਚਿਆ ਨਹੀਂ ਦੋ ਦਿਨ ਲੇਟ ਆਇਆ ਉਸ ਤੋਂ ਬਾਅਦ ਜਦੋਂ ਬੋ ਉਹਦਾ ਡੱਬਾ ਸੀ ਜੋ ਖੋਲ੍ਹ ਕੇ ਦੇਖਿਆ ਤਾਂ ਉਹ ਪੈਕਿੰਗ ਵੀ ਸਹੀ ਨਹੀਂ ਸੀਗੀ ਅਤੇ ਖੋਲ੍ਹ ਕੇ ਦੇਖਿਆ ਤਾਂ ਚਾਰਜਰ ਸੀਗਾ ਜੋ ਚਾਰਜਰ ਦੀ ਤਾਰ ਸੀਗੀ ਉਹ ਟੁੱਟੀ ਹੋਈ ਸੀਗੀ ਠੀਕ ਹੈ ਜੀ ਫਿਰ ਉਹ ਕੰਪਨੀ ਨੇ ਉਹ ਚਾਰਜਰ ਵਾਪਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਕਹਿੰਦੇ ਵੀ ਤੁਸੀਂ ਗਲਤ ਚਾਰਜਰ ਭੇਜਦੇ ਹੋ ਜਾਂ ਵੀ ਇਹ ਅਸੀਂ ਨਹੀਂ ਭੇਜਿਆ ਠੀਕ ਹੈ ਜੀ ਇੱਦਾਂ ਕਰਕੇ ਅਤੇ ਇਸੇ ਤਰ੍ਹਾਂ ਵੀ ਥੋੜ੍ਹਾ ਜੋ ਇਸ ਆਨਲਾਈਨ ਇੰਟਰਨੈਟ ਦੇ ਜੋ ਆਪਾਂ ਜੋ ਖਰੀਦਦਾਰੀ ਕਰਦੇ ਹਾਂ ਉਹਦੇ ਫਾਇਦੇ ਵੀ ਨੇ ਅਤੇ ਨੁਕਸਾਨ ਵੀ ਨੇ